ਭੰਗੜੇ ਦੇ ਆਮ ਸਟੈਪ ਅਤੇ ਪੰਜਾਬੀ ਸੱਭਿਆਚਾਰ ਵਿੱਚ ਉਹਨਾਂ ਦੀ ਮਹੱਤਤਾ ਭੰਗੜਾ ਇਕ ਅਜਿਹਾ ਨਾ ਸਰੀਰ ਦੀ ਹਰ ਹਰਕਤ ਖੁਸ਼ੀ ਅਤੇ ਜੋਸ਼ ਨਾਲ ਭਰੀ ਹੁੰਦੀ ਹੈ ਇਸੇ ਸਟੈਪ ਬਹੁਤ ਸਾਰੇ ਹਨ ਅਤੇ ਇਹ ਸਮੇਂ ਅਤੇ ਥਾਂ ਦੇ ਨਾਲ ਨਾਲ ਬਦਲਦੇ ਰਹਿੰਦੇ ਹਨ ਹਾਲਾਂਕਿ ਕੁਝ ਆਮ ਸਟੈਪ ਹਨ ਜੋ ਹਰ ਭੰਗੜੇ ਵਿੱਚ ਲੱਭੀ ਜਾ ਸਕਦੇ ਹਨ ਭੰਗੜੇ ਦੇ ਕੁਝ ਆਮ ਸਟੈਪ ਤਾਲੀਆਂ ਤਾਲੀਆਂ ਭੰਗੜੇ ਦਾ ਅਣਖੀਲਾ ਅੰਗ ਹਨ ਇਹ ਨਾ ਸਿਰਫ ਤਾਲ ਨੂੰ ਬਣਾਈ ਰੱਖਦੇ ਹਨ ਸੋ ਹੁਣ ਤਿੰਨ ਵਾਲਿਆਂ ਨੂੰ ਵੀ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰਦੀਆਂ ਹਨ ਪੈਰਾਂ ਦੇ ਘੁਮਾਵ ਭੰਗੜੇ ਅਤੇ ਪੈਰਾਂ ਨੂੰ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਇਹ ਸਟੈਪ ਭੰਗੜੇ ਦੀ ਜੋਸ਼ ਨਾਲ ਭਰ ਦਿੰਦਾ ਹੈ ਹੱਥਾਂ ਹੱਥਾਂ ਅਤੇ ਹਰਕਤਾਂ ਵਿੱਚ ਭੰਗੜੇ ਭੰਗੜੇ ਵਿੱਚ ਹੱਥਾਂ ਦੀਆਂ ਬਹੁਤ ਹੀ ਬਹੁਤ ਸਾਰੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਇਹ ਹਰਕਤਾਂ ਨਾਚ ਨੂੰ ਹੋਰ ਵੀ ਰੰਗੀਨ ਬਣਾਉਂਦੀਆਂ ਹਨ ਸ਼ਰੀਰ ਨੂੰ ਹਿਲਾਉਣਾ ਭੰਗੜੇ ਵਿੱਚ ਸਾਰੀ ਸਰੀਰ ਨੂੰ ਹਿਲਾਇਆ ਜਾਂਦਾ ਹੈ ਇਸ ਤਰ੍ਹਾਂ ਕੰਮ ਨੂੰ ਹਿਲਾਉਣਾ ਮੋਢੇ ਨੂੰ ਹਿਲਾਉਣਾ ਅਤੇ ਸਿਰ ਨੂੰ ਹਿਲਾਉਣਾ ਸ਼ਾਮਿਲ ਹੈ ਭੰਗੜੇ ਸਟੈਪ 'ਤੇ ਪੰਜਾਬੀ ਸੱਭਿਆਚਾਰ ਭੰਗੜੇ ਦੇ ਇਹ ਸਟੈਪ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਬਾਹ ਨੂੰ ਬਹੁਤ ਵਧੀਆ ਤਰੀਕੇ ਨਾਲ ਦਰਸਾਉਂਦੇ ਹਨ ਜੋਸ਼ ਅਤੇ ਉਤਸ਼ਾਹ ਭੰਗੜੇ ਦੇ ਤੇ ਸਟੈਪ ਉਹਦੇ ਤਾਲੀਆਂ ਨੱਚਣ ਵਾਲਿਆਂ ਵਿੱਚ ਜੋਸ਼ ਹ ਚਾਹ ਪੈਦਾ ਕਰਦੀਆਂ ਹਨ ਇਹ ਪੰਜਾਬੀਆਂ ਦੇ ਜਸੀਲੇ ਸਵਾਲ ਨੂੰ ਦਰਸਾਉਂਦਾ ਹੈ ਖੁਸ਼ੀ ਭੰਗੜੇ ਦੇ ਹਹ ਸਟੇਪ ਵਿੱਚ ਖੁਸ਼ੀ ਝਲਕਦੀ ਹੈ ਅਤੇ ਇਹ ਪੰਜਾਬੀਆਂ ਦੇ ਜੀਵਨ ਨੂੰ ਖੁਸ਼ੀ ਨਾਲ ਜੀਣ ਦੇ ਤਰੀਕੇ ਦਰਸਾਉਂਦਾ ਹੈ ਸਮੂਹਿਕ ਸਮੂਹਿਕਤਾ ਪੰਜਾਬ ਭੰਗੜੇ ਵਿੱਚ ਨਸਾਰੇ ਨੱਚਣ ਵਾਲੇ ਇੱਕ ਦੂਜੇ ਨਾਲ ਮਿਲ ਕੇ ਨੱਚਦੇ ਹਨ ਇਹ ਪੰਜਾਬੀਆਂ ਸਮੂਹਿਕ ਸੁਭਾਅ ਨੂੰ ਦਰਸਾਉਂਦਾ ਹੈ ਸਰਲਤਾ ਭੰਗੜੇ ਦੇ ਸਟੈਪ ਬਹੁਤ ਸੱਰਲ ਹੁੰਦੇ ਹਨ ਇਹ ਕਿਸੇ ਵੀ ਉਮਰ ਦੇ ਵਿਅਕਤੀ ਦੁਆਰਾ ਸਿੱਖੇ ਜਾ ਸਕਦੇ ਹਨ ਇਹ ਪੰਜਾਬੀਆਂ ਦੀ ਸਰਲਤਾ ਨੂੰ ਦਰਸਾਉਂਦਾ ਹੈ ਭੰਗੜੇ ਸਟੈਪ ਨਾ ਸਿਰਫ ਇੱਕ ਨਾਚ ਹਨ ਸਗੋਂ ਪੰਜਾਬੀ ਸੱਭਿਆਚਾਰ ਦੇ ਇਕ ਅਨ੍ਖਿੜਵਾ ਅੰਗ ਹਨ ਇਹ ਸਟੈਪ ਪੰਜਾਬੀਆ ਦੇ ਜੋਸ਼ ਉਤਸਾਹ ਖੁਸ਼ੀ ਸਮੁਖਤਾ ਅਤੇ ਸਰਲ ਤੁਹਾਨੂੰ ਦਰਸਾਉਂਦਾ ਹੈ ਤੁਸੀਂ ਭੰਗੜੇ ਬਾਰੇ ਹੋਰ ਵੀ ਕੁਝ ਜਾਣਨਾ ਚਾਹੁੰਦੇ ਹੋ ਭੰਗੜੇ ਦੇ ਵੱਖ ਵੱਖ ਅੰਦੋਲਨਾਂ ਬਾਰੇ ਭੰਗੜੇ ਦੇ ਇਤਿਹਾਸ ਬਾਰੇ ਭੰਗੜੇ ਦੇ ਪ੍ਰਸਿੱਧ ਗੀਤਾਂ ਬਾਰੇ ਭੰਗੜੇ ਸਿੱਖਣ ਦੇ ਤਰੀਕਿਆਂ ਬਾਰੇ